ਹੈਲੋ ਹੈਲੋ ਹੈਲੋ ਹਾਂਜੀ ਕੌਣ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸੋ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਕੀ ਕੀ ਤੁਹਾਨੂੰ ਪ੍ਰੋਬਲਮ ਹੈ ਜੀ ਠੀਕ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਮਤਲਬ ਕੋਈ ਗੱਲ ਨਹੀਂ ਤੁਸੀਂ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਜੀ ਤੁਹਾਡੀ ਕੰਪਲੇਂਟ ਮਤਲਬ ਕਿ ਹਾਂਜੀ ਲਿਖੀ ਗਈ ਹੈ ਅਤੇ ਕੋਈ ਨਹੀਂ ਅਸੀਂ ਇਸ ਮਤਲਬ ਕਿ ਅਸੀਂ ਇਸ 'ਚ ਬਹੁਤ ਧਿਆਨ ਦੇਵਾਂਗੇ ਔਰ ਮੈਂ ਮਤਲਬ ਕਿ ਅੱਗੇ ਉਹਨਾਂ ਦੇ ਆਪਣੇ ਨਗਰ ਕੋਸ਼ ਵਾਲੇ ਆਪਣੇ ਉੱਥੇ ਮੈਂ ਤੁਹਾਡੇ ਭੇਜ ਰਹੀ ਹਾਂ ਅਤੇ ਕੋਈ ਨਹੀਂ ਇਸ ਚੀਜ਼ ਦਾ ਤੁਹਾਡਾ ਹੱਲ ਹੋ ਜੇਗਾ ਹਾਂਜੀ

ਠੀਕ ਹੈ ਜੀ ਹਮ ਹਮ

ਹਾਂਜੀ ਹਾਂਜੀ ਉਹ ਤਾਂ ਹੈ ਤੁਸੀਂ ਪਹਿਲਾਂ ਵੀ ਕੰਪਲੇਂਟ ਲਿਖਵਾਈ ਆ ਕੋਈ ਸੁਣਵਾਈ ਨਹੀਂ ਹੋਈ ਹਮ ਹਮ ਅੱਛਾ ਹਾਂ ਹਾਂਜੀ ਹਾਂਜੀ ਹਾਂਜੀ ਚਲੋ ਕੋਈ ਬਿਲਕੁਲ ਬਿਲਕੁਲ ਜੀ ਬਾਕੀ ਕੋਈ ਨਹੀਂ ਤੁਸੀਂ ਤੁਹਾਡੀ ਕੰਪਲੇਂਟ ਲਿਖੀ ਗਈ ਆ ਔਰ ਮੈਂ ਮਤਲਬ ਕਿ ਉੱਥੇ ਉਹਨਾਂ ਨੂੰ ਦਿੰਦੀ ਹਾਂ ਬਾਕੀ ਕੋਈ ਗੱਲ ਨਹੀਂ ਅਸੀਂ ਆਣ ਕੇ ਫਿਰ ਦੇਖਦੇ ਹਾਂ ਜੀ ਚਲੋ ਠੀਕ ਹੈ ਜੀ ਫਿਰ ਓਕੇ ਬਾਏ